ਫਸਲਾਂ ਦੇ ਵਿੱਚ ਪਸ਼ੂਆਂ ਤੋਂ ਰਾਖੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਈ ਤਰ੍ਹਾਂ ਦੇ ਜਾਨਵਰ ਹੁੰਦੇ ਹਨ ਜੋ ਕਿ ਜਿਹੜੇ ਕਿ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੇ ਹਨ ਜਿਵੇਂ ਕਿ ਆਪਾਂ ਆਮ ਹੀ ਦੇਖਦੇ ਹਾਂ ਕਿ ਖੇਤਾਂ ਦੇ ਵਿੱਚ ਜੰਗਲੀ ਸੂਰ ਹੁੰਦੇ ਹਨ ਜਿਹੜੇ ਕਿ ਬਹੁਤ ਜ਼ਿਆਦਾ ਸਬਜ਼ੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿਵੇਂ ਕਿ ਆਲੂ ਗਾਜਰਾਂ ਇਹ ਚੀਜ਼ਾਂ ਹਨ ਜੋ ਜੰਗਲੀ ਸੂਰ ਬਹੁਤ ਜ਼ਿਆਦਾ ਖਰਾਬ ਕਰਦੇ ਹਨ ਅਤੇ ਆਪਾਂ ਹੋਰ ਵੀ ਦੇਖ ਸਕਦੇ ਹਾਂ ਕਈ ਅਵਾਰਾ ਪਸ਼ੂ ਜਿਵੇਂ ਗਾਵਾਂ ਵੱਛੇ ਵੱਛੀਆਂ ਆਦਿ ਬਹੁਤ ਜ਼ਿਆਦਾ ਵੱਧ ਗਏ ਨੇ ਜਿਹੜੇ ਕਿ ਕੱਚੀਆਂ ਫਸਲਾਂ ਦੇ ਵਿੱਚ ਫਸਲਾਂ ਨੂੰ ਖਾ ਲੈਂਦੇ ਹਨ ਜਿਵੇਂ ਕਣਕ ਝੋਨੇ ਦੀਆਂ ਫਸਲਾਂ ਨੂੰ ਉਹ ਜਿਹੜੇ ਜਿਹੜੇ ਪੌਦਿਆਂ ਦੇ ਦਾਣੇ ਲੱਗਣੇ ਹੁੰਦੇ ਹਨ ਉਹ ਪੌਦੇ ਖਾ ਜਾਂਦੇ ਹਨ ਅਤੇ ਜਿਹਦੇ ਕਰਕੇ ਫਸਲਾਂ ਦੇ ਦਾਣੇ ਨਹੀਂ ਉੱਗ ਪਾਉਂਦੇ ਅਤੇ ਫਸਲਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਇਹਨਾਂ ਦੀ ਸੁਰੱਖਿਆ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਦੇ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹਨਾਂ ਦੀ ਜਿਹੜੀ ਸੁਰੱਖਿਆ ਹੈ ਫਸਲਾਂ ਦੀ ਜਾਨਵਰਾਂ ਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਖੇਤਾਂ ਦੇ ਵਿੱਚ ਰਾਖੀ ਵਾਸ ਰਾਖੀ ਵਿੱਚ ਰਾਖੀ ਵਾਸਤੇ ਕਈ ਤਰ੍ਹਾਂ ਦੀਆਂ ਕੰਡਿਆਲੀ ਤਾਰਾਂ ਲਾਈਆਂ ਜਾ ਸਕਦੀਆਂ ਨੇਗੀਆਂ ਅਤੇ ਕਈ ਜਿਹੜੇ ਲੋਕ ਨੇ ਉਹ ਖੇਤਾਂ ਦੇ ਵਿੱਚ ਮਣੇ ਬਣਾ ਕੇ ਬੈਠਦੇ ਹਨ ਤਾਂ ਕਿ ਜਿਹੜੇ ਆਉਣ ਵਾਲੇ ਜਿਹੜੇ ਜਾਨਵਰ ਹਨ ਉਹਨਾਂ ਨੂੰ ਡਰਾ ਕੇ ਭਜਾਇਆ ਜਾ ਸਕੇ ਇਸ ਤਰ੍ਹਾਂ ਬਹੁਤ ਜ਼ਿਆਦਾ ਜਿਹੜੇ ਕਿਸਾਨ ਨੇ ਉਹ ਖੇਤਾਂ ਦੇ ਵਿੱਚ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਆਹ ਜਿਹੜੇ ਪਸ਼ੂ ਨੇ ਉਹਨਾਂ 'ਤੇ ਨਿਗਰਾਨੀ ਰੱਖਦੇ ਹਨ ਅਤੇ ਉਹਨਾਂ ਨੂੰ ਭਜਾਉਂਦੇ ਹਨ ਤਾਂ ਕਿ ਜਿਹੜੀਆਂ ਫਸਲਾਂ ਉਹ ਖਰਾਬ ਨਾ ਹੋਣ